ਹਾਂਜੀ ਪ੍ਰੀਤਇੰਦਰ ਗੱਲ ਕਰ ਰਹੇ ਹਾਂਜੀ ਪ੍ਰੀਤਇੰਦਰ ਥਾਣਾ ਥਰਮਲ ਤੋਂ ਗੱਲ ਕਰ ਰਿਹਾ ਸੀ ਮੈਂ ਹਾਂਜੀ ਤੁਹਾਡੀ ਨਾ ਪਾਸਪੋਰਟ ਦੀ ਵੈਰੀਫਿਕੇਸ਼ਨ ਆਈ ਹੋਈ ਆ ਹਾਂਜੀ ਅਤੇ ਤੁਸੀਂ ਮੇਰੇ ਕੋਲ ਕੱਲ੍ਹ ਪਹੁੰਚਣਾ ਸਵੇਰੇ ਦਸ ਵਜੇ ਅਤੇ ਫਰੀ ਹੋ ਦਸ ਵਜੇ ਸਵੇਰੇ ਠੀਕ ਹੈ ਜੀ ਅਤੇ ਤੁਸੀਂ ਆਪਣੇ ਨਾਲ ਡਾਕੂਮੈਂਟਸ ਲੈ ਕੇ ਆਉਣੇ ਹੈ ਮਾੜਾ ਜਿਹਾ ਨੋਟ ਕਰ ਲਓ ਕਿਹੜੇ ਕਿਹੜੇ ਲੈ ਕੇ ਆਉਣੇ ਅ ਇੱਕ ਤਾਂ ਆਧਾਰ ਕਾਰਡ ਲੈ ਕੇ ਆਉਣਾ ਇੱਕ ਪੈਨ ਕਾਰਡ ਲੈ ਕੇ ਆਉਣਾ ਜੀ ਹਾਂ ਇੱਕ ਪੈਨ ਕਾਰਡ ਲੈ ਕੇ ਆਉਣਾ ਇੱਕ ਦਸਵੀਂ ਦੀ ਲੈ ਕੇ ਆਉਣੀ ਹੈ ਡੀ ਐੱਮ ਸੀ ਜੀ ਦਸਵੀਂ ਦੀ ਸਰਟੀਫਿਕੇਟ ਠੀਕ ਹੈ ਜੀ ਅਤੇ ਨਾਲ ਦੋ ਗਵਾਹ ਲੈ ਕੇ ਆਉਣੇ ਹੈ ਜੀ ਲੇਡੀਜ਼ ਜਾਂ ਜੈਂਟਸ ਕੋਈ ਵੀ ਹੋਣ ਦੋ ਚਾਹੀਦੇ ਹੈ ਤੁਹਾਡੇ ਗੁਆਂਢੀ ਡਾਕੂਮੈਂਟ ਸਾਰੇ ਓਰੀਜਨਲ ਚਾਹੀਦੇ ਹੈ ਅਤੇ ਜਿਹੜੇ ਗੁਆਂਢੀ ਲੈ ਕੇ ਆਉਂਗੇ ਉਹਨਾਂ ਦਾ ਆਧਾਰ ਕਾਰਡ ਚਾਹੀਦਾ ਨਾਲ ਓਰੀਜਨਲ ਹਾਂਜੀ ਅਤੇ ਕੱਲ੍ਹ ਨਹੀਂ ਨਹੀਂ ਨਹੀਂ ਨਹੀਂ ਇਕੱਲੇ ਗੁਆਂਢੀ ਚੱਲਣਗੇ ਫੈਮਲੀ ਮੈਂਬਰ ਨਹੀਂ ਚੱਲੂਗਾ ਗੁਆਂਢੀ ਹੋਊਗਾ ਮੇਲ ਜੈਂਟ ਮੇਲ ਜਾਂ ਫੀਮੇਲ ਕੋਈ ਵੀ ਤੁਹਾਡੇ ਵਾਰਡ 'ਚੋ ਕੋਈ ਵੀ ਗੁਆਂਢੀ ਹੋਵੇ ਤੁਹਾਡਾ ਜਿਹੜਾ ਗਵਾਹੀ ਪਾ ਸਕਦਾ ਉਹਦਾ ਆਧਾਰ ਕਾਰਡ ਨਾਲ ਲੈ ਕੇ ਆਉਣਾ ਜ਼ਰੂਰੀ ਹੈ ਉਹਦਾ ਆਧਾਰ ਕਾਰਡ ਨਾਲ ਲੈ ਕੇ ਆਉਣਾ ਅਤੇ ਸੌ ਰੁਪਈਆ ਫੀਸ ਲੱਗੂਗੀ ਉਹ ਨਾਲ ਲੈ ਕੇ ਆਉਣੀ ਹੈ ਜੀ ਹਾਂਜੀ ਅਤੇ ਸਵੇਰੇ ਸਹੀ ਦਸ ਵਜੇ ਆ ਜਾਇਓ ਮੇਰੇ ਕੋਲ ਥਾਣਾ ਥਰਮਲ ਦੇ ਵਿੱਚ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਜੀ